ਤੁਸੀਂ ਭਗਤੀ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਨਾ ਜੀ ਤੁਹਾਡੇ ਤੋਂ ਕੱਲ੍ਹ ਖਾਣਾ ਮੰਗਵਾਇਆ ਸੀਗਾ ਜਿਵੇਂ ਕਿ ਮੈਂ ਰੋਜ਼ ਰੋਟੀਨ ਦੇ ਵਿੱਚ ਆਪਣੇ ਪੀਜੀ ਵਿੱਚ ਤੁਹਾਡੇ ਇਸੇ ਢਾਬੇ ਤੋਂ ਖਾਣਾ ਮੰਗਵਾਉਂਦਾ ਪਰ ਜਿਹੜਾ ਕੱਲ੍ਹ ਖਾਣਾ ਮੈਨੂੰ ਮਿਲਿਆ ਉਹ ਮੈਨੂੰ ਐਵੇਂ ਲੱਗਿਆ ਵੀ ਬਹੁਤ ਜ਼ਿਆਦਾ ਬਾਸੀ ਜਾਂ ਖਸਤਾ ਹਾਲਤ ਦੇ ਵਿੱਚ ਤਾਂ ਕਿਤੇ ਕਿਤੇ ਮੈਨੂੰ ਸੁੰਡ ਵੀ ਦਿਖੇ ਹੁਣ ਮੈਂ ਤਾਂ ਹੀ ਜਾਂ ਤਾਂ ਕੰਪਲੇਂਟ ਕਰਦਾ ਕਿਹਨੂੰ ਫਿਰ ਮੈਂ ਸੋਚਿਆ ਚਲੋ ਤੁਹਾਨੂੰ ਹੀ ਫੋਨ ਕਰਦਾਂ ਕੱਲ੍ਹ ਤਾਂ ਮੈਨੂੰ ਟਾਈਮ ਲੱਗਿਆ ਨਹੀਂ ਫਿਰ ਮੈਂ ਤੁਹਾਨੂੰ ਅੱਜ ਫੋਨ ਕਰ ਰਿਹਾਂ ਦੱਸਣ ਦਾ ਮੇਰਾ ਤਾਂ ਫਰਜ਼ ਹੈ ਵੀ ਅੱਗੇ ਵਾਸਤੇ ਜੇ ਮੇਰੀ ਥੋਡ ਤੁਹਾਡੀ ਕੋਈ ਹਰਕਤ ਹੁੰਦੀ ਹੈ ਅਤੇ ਤੁਹਾਡਾ ਜਿਹੜਾ ਢਾਬਾ ਸਹੀ ਨਹੀਂ ਚੱਲਣਾ ਅਤੇ ਤੁਸੀਂ ਇਹ ਚੀਜ਼ 'ਤੇ ਗੌਰ ਕਰੋ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਕਰਮਚਾਰੀ ਨੇ ਤੁਹਾਡੀ ਰਸੋਈ ਦੇ ਵਿੱਚ ਉਹਨਾਂ ਨੂੰ ਤਾੜਨਾ ਕਰੋ ਕਿ ਤਾਂ ਜੋ ਇਹੋ ਜਿਹਾ ਖਾਣਾ ਅੱਗੇ ਵਾਸਤੇ ਕਿਸੇ ਵੀ ਕਸਟਮਰ ਨੂੰ ਨਾ ਭੇਜਣ ਅਤੇ ਇਹਦੇ ਨਾਲ ਤੁਹਾਡੀ ਦੁਕਾਨਦਾਰੀ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਵੇਗਾ ਅਤੇ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਅਤੇ ਅੱਗੇ ਵਾਸਤੇ ਧਿਆਨ ਰੱਖਿਓ